ਹਾਂਜੀ ਖਾਣਾ ਸਿਰਫ ਔਰਤਾਂ ਦਾ ਹੀ ਕੰਮ ਨਹੀਂ ਹੁੰਦਾ ਇਹ ਸਾਰਿਆਂ ਨੂੰ ਘਰ ਵਿੱਚ ਰਲ਼ ਮਿਲ ਕੇ ਬਣਾਉਣਾ ਸਿੱਖਣਾ ਚਾਹੀਦਾ ਹੈ ਆਉਣਾ ਵੀ ਚਾਹੀਦਾ ਬੰਦਿਆਂ ਨੂੰ ਵੀ ਮਰਦਾਂ ਨੂੰ ਵੀ ਆਉਣਾ ਚਾਹੀਦਾ ਖਾਣਾ ਬਣਾਉਣਾ ਕਿਉਂਕਿ ਰੋਜ਼ ਆਪਾਂ ਨੂੰ ਰੋਟੀ ਖਾਏ ਬਿਨ੍ਹਾਂ ਤਾਂ ਆਪਾਂ ਦਾ ਕੰਮ ਨੀ ਚੱਲਦਾ ਏ ਬਾਹਰੋਂ ਖਾਵਾਂਗੇ ਤਾਂ ਪੇਟ ਖਰਾਬ ਹੁੰਦਾ ਏ ਇੰਨੀਆਂ ਬਿਮਾਰੀਆਂ ਲੱਗਦੀਆਂ ਏ ਪਤਾ ਨੀ ਕਿੰਨੇ ਗੰਦੇ ਹੱਥਾਂ ਨਾਲ ਉਹ ਬਣਾ ਕੇ ਉਹ ਸਾਨੂੰ ਪਰੋਸਦੇ ਆ ਕਦੇ ਜਨਾਨੀ ਨੂੰ ਕਿਤੇ ਬਾਹਰ ਜਾਣਾ ਪੈ ਜਾਂਦਾ ਅੱਜ ਕੱਲ੍ਹ ਜਿਵੇਂ ਨੌਕਰੀਆਂ ਕਰਦੀਆਂ ਸਾਰੀਆਂ ਜਨਾਨੀਆਂ ਅਤੇ ਉਸ ਵਿੱਚ ਵੀ ਮਰਦ ਨੂੰ ਹੈਲਪ ਕਰਨੀ ਚਾਹੀਦੀ ਆ ਜਨਾਨੀ ਨਾਲ ਮਦਦ ਕਰਨੀ ਚਾਹੀਦੀ ਖਾਣਾ ਬਣਾਉਣ ਵਿੱਚ ਰਲ਼ ਮਿਲ ਕੇ ਦੋਨਾਂ ਦਾ ਹੀ ਫਰਜ਼ ਬਣਦਾ ਏ ਖਾਣਾ ਬਣਾਉਣਾ ਬ ਬੰਦੇ ਦਾ ਵੀ ਅਤੇ ਜਨਾਨੀ ਦਾ ਵੀ ਅਤੇ ਬੰਦੇ ਨੂੰ ਵੀ ਜਿੰਨਾ ਜਨਾਨੀ ਨੇ ਸਿੱਖਿਆ ਹੁੰਦਾ ਓਨਾ ਹੀ ਬੰਦੇ ਨੂੰ ਵੀ ਸਿੱਖਣਾ ਚਾਹੀਦਾ ਹੈ ਅਤੇ ਖਾਣਾ ਬਣਾਉਣ ਦਾ ਕੋਈ ਉਹ ਨੀ ਹੈਗਾ ਆਪਣਾ ਘਰ ਸਾਫ ਸੁਥਰਾ ਖਾਣਾ ਬਣਾ ਕੇ ਖਾਣਾ ਚਾਹੀਦਾ ਹੈ